ਦੇਖੋ ਜੀ ਜਿੱਥੇ ਤੱਕ ਹਸਪਤਾਲਾਂ ਦੀ ਗੱਲ ਆ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੁਧਾਰ ਹਸਪਤਾਲਾਂ ਵਿੱਚ ਪਹਿਲਾਂ ਤਾਂ ਨਾਂ ਤਾਂ ਕੋਈ ਡਾਕਟਰ ਲੱਭਦਾ ਸੀ ਨਾ ਕੋਈ ਸਟਾਫ਼ ਮਿਲਦਾ ਹੁੰਦਾ ਸੀ ਅੱਜ ਦੇ ਸਮੇਂ 'ਚ ਡਾਕਟਰ ਆਪਣੇ ਟਾਈਮ 'ਤੇ ਡਿਊਟੀ 'ਤੇ ਹੁੰਦੇ ਆ ਹਰ ਸਹੂਲਤ ਸਾਨੂੰ ਸਰਕਾਰੀ ਹਸਪਤਾਲਾਂ ਵਿੱਚ ਮਿਲਦੀ ਪਈ ਆ ਇਥੋਂ ਤੱਕ ਕਿ ਮੁਫ਼ਤ ਦਵਾਈਆਂ ਜੇ ਕਿਸੇ ਦਾ ਕਾਰਡ ਨਹੀਂ ਬਣਿਆ ਆਯੁਸ਼ਮਾਨ ਦਾ ਉਹ ਕਾਰਡ ਬਣਾਉਣ ਦੀ ਸੁਵਿਧਾ ਵੀ ਹਸਪਤਾਲਾਂ ਵਿੱਚ ਮੌਜੂਦ ਹੈ ਪਹਿਲਾਂ ਟੈਸਟ ਕਰਵਾਉਣ ਵਾਸਤੇ ਬਾਹਰ ਜਾਣਾ ਪੈਂਦਾ ਸੀ ਧੱਕੇ ਖਾਣੇ ਪੈਂਦੇ ਸੀ ਅਤੇ ਹੁਣ ਟੈਸਟ ਹਸਪਤਾਲਾਂ ਵਿੱਚ ਹੀ ਹੁੰਦੇ ਆ ਅਤੇ ਕਾਫ਼ੀ ਫ਼ਰਕ ਆ ਬਾਹਰ ਜਿਹੜੇ ਟੈਸਟ ਛੇ ਛੇ ਹਜ਼ਾਰ ਦੇ ਹੁੰਦੇ ਸੀ ਉਹ ਅੱਜ ਕੱਲ੍ਹ ਹਸਪਤਾਲਾਂ ਵਿੱਚ ਸਰਕਾਰੀ ਰੇਟ ਦੇ ਹਿਸਾਬ ਨਾਲ ਵੱਖ ਵੱਖ ਜਿਹੜੀ ਉਹਦੀਆਂ ਕੀਮਤਾਂ ਵਾ ਉਸ ਹਿਸਾਬ ਨਾਲ ਹੁੰਦੇ ਆ ਹਾਂਜੀ ਪਹਿਲਾਂ ਨਾਲੋਂ ਹੁਣ ਬਹੁਤ ਬਿਹਤਰ ਹੋ ਚੁੱਕਿਆ ਹੈ ਦੇਖੋ ਗੱਲ ਰਹੀ ਕੋਵਿਡ ਮਹਾਂਮਾਰੀ ਦੀ ਹੁਣ ਦੇਖੋ ਕੋਵਿਡ ਕਰਕੇ ਬੜੀਆਂ ਜਾਨਾਂ ਗਈਆਂ ਹਸਪਤਾਲਾਂ ਵਿੱਚ ਵੀ ਉੱਥੇ ਕੀ ਉਹਨਾਂ ਨੂੰ ਜੋ ਮੈਡੀਸਨ ਦਿੰਦੇ ਸੀ ਵਿਚਾਰੇ ਉਹ ਹੀ ਬਸ ਰੱਬ ਆਸਰੇ ਤੁਰੇ ਰਹਿੰਦੇ ਸੀ ਲੋਕ ਇਹ ਨੁਕਸਾਨ ਕਾਫ਼ੀ ਹੋਇਆ ਕੋਵਿਡ ਬਾਰੇ ਇਹਦੇ ਬਾਰੇ ਮੈਂ ਕੁਛ ਵੀ ਨਹੀਂ ਕਹਿਣਾ ਚਾਵਾਂਗਾ ਕਿਉਂਕਿ ਜਦੋਂ ਤੱਕ ਐਂਟੀਡੋਡ ਨਹੀਂ ਹੈਗਾ ਵੈਕਸੀਨ ਨਹੀਂ ਆਈ ਓਦੋਂ ਤੱਕ ਕਾਫ਼ੀ ਬੁਰੇ ਹਾਲ ਰਹੇ ਆ ਲੋਕਾਂ ਨੂੰ ਕੋਰੀਡੋਰ ਹੋਣਾ ਹੋਣਾ ਪਿਆ ਘਰਾਂ ਵਿੱਚ ਹੀ ਅਤੇ ਚੱਲੋ ਆਪਾਂ ਇਹਦੇ ਬਾਰੇ ਕੋਈ ਗੱਲ ਨਹੀਂ ਕਰਦੇ ਲੇਕਿਨ ਹੁਣ ਇਹਦਾ ਹੈ ਕਿ ਚਲੋ ਜਦੋਂ ਦਾ ਇਹਦਾ ਡੋਜ ਬਣ ਗਈ ਸੀ ਵੈਕਸੀਨੇਸ਼ਨ ਅਤੇ ਵਧੀਆ ਰਿਹਾ ਉਸ ਤੋਂ ਬਾਅਦ ਕਿਸੇ ਨੂੰ ਕੋਈ ਤਰ੍ਹਾਂ ਦੀ ਦਿੱਕਤ ਨਹੀਂ ਆਈ ਸਾਡੇ ਹਸਪਤਾਲ ਗੁਰਦਾਸਪੁਰ ਵਿੱਚ ਠੀਕ ਆ ਸਾਰਾ ਸਿਸਟਮ ਲੇਕਿਨ ਜਿਹੜੀ ਪਾਰਕਿੰਗ ਦੀ ਆ ਇੱਕ ਤਾਂ ਬੰਦਾ ਵਿਚਾਰਾ ਵੈਸੇ ਆਇਆ ਹੁੰਦਾ ਮਜ਼ਬੂਰ ਦੁਖੀ ਉੱਧਰੋਂ ਪਾਰਕਿੰਗ ਵਾਲੇ ਬਹਿ ਉੱਥੇ ਅੱਡਾ ਲਾ ਕੇ ਬੰਦੇ ਆਪਣਾ ਇਲਾਜ ਕਰਵਾਉਣ ਵਾਸਤੇ ਦੇਖੋ ਜਿਹੜਾ ਬੰਦਾ ਪ੍ਰਾਈਵੇਟ ਹਸਪਤਾਲ 'ਚ ਸਰਕਾਰੀ ਹਸਪਤਾਲ 'ਚ ਆ ਰਿਹਾ ਉਹ ਕਿੰਨਾ ਕੁ ਪੈਸੇ ਵਾਲਾ ਮਜ਼ਬੂਰ ਹੋਵੇਗਾ ਇਹ ਆਉਂਦੇ ਹੀ ਬਾਹਰ ਵਾਲੇ ਨੇ ਪਰਚੀ ਲਾਈ ਦੀ ਆ ਕਿ ਪਰਚੀ ਕਟਾਓ ਅਤੇ ਅੰਦਰ ਜਾਓ ਇੱਥੇ ਵੈਸੇ ਚਾਹੀਦਾ ਕਿ ਇਹ ਜਿਹੜੀ ਆ ਪਰਚੀ ਆ ਪਾਰਕਿੰਗ ਦੀ ਬੰਦ ਹੋਣੀ ਚਾਹੀਦੀ ਆ ਬਸ ਜੀ ਧੰਨਵਾਦ ਜੀ